ਹਾਂਜੀ ਪੰਜਾਬ ਵਿੱਚ ਪ੍ਰਮੁੱਖ ਸਿਆਸੀ ਪਾਰਟੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਬੀ ਜੇ ਪੀ ਕਾਂਗਰਸ ਐਂਡ ਆਮ ਆਦਮੀ ਪਾਰਟੀ ਇਹਨਾਂ ਦੇ ਮੋਟੋ ਹੈ ਜਿਵੇਂ ਆਮ ਆਦਮੀ ਪਾਰਟੀ ਦਾ ਮੋਟੋ ਹੈ ਝਾੜੂ ਇਹ ਆਮ ਆਦਮੀ ਪਾਰਟੀ ਦਾ ਮੋਟੋ ਦਾ ਮਤਲਬ ਹੈ ਕਿ ਝਾੜੂ ਝਾੜੂ ਇਹ ਕਿ ਸਾਰੇ ਨਾ ਇਹਨਾਂ ਨੇ ਕਰਪਸ਼ਨ ਖ਼ਤਮ ਕਰਕੇ ਇੱਕ ਕਲੀਨ ਚਿੱਟ ਦੇ ਤੀ ਕਿ ਇਹਨਾਂ ਨੂੰ ਐਂ ਸੀ ਕਿ ਜਿਹੜੇ ਕਰਪਸ਼ਨ ਕਰਦੇ ਨੇ ਉਹਨਾਂ ਦੇ ਅਗੇਂਸਟ ਕਾਰਵਾਈ ਕਰਨਾ ਕਰਪਸ਼ਨ ਨੂੰ ਖ਼ਤਮ ਕਰਨਾ ਕਿਸੇ ਤੋਂ ਕੋਈ ਪੈਸੇ ਲੈ ਕੇ ਰਿਸ਼ਵਤ ਲੈ ਕੇ ਕੰਮ ਨਹੀਂ ਕਰਨਾ ਕਿਉਂਕਿ ਰਿਸ਼ਵਤ ਲੈ ਕੇ ਜਿਹੜੇ ਗਰੀਬ ਲੋਕ ਨੇ ਰਿਸ਼ਵਤ ਨਹੀਂ ਨਹੀਂ ਦੇ ਸਕਦੇ ਉਹਨਾਂ ਦਾ ਕੰਮ ਕਿਵੇਂ ਹੋਊਗਾ ਠੀਕ ਹੈ ਉਸ ਤੋਂ ਬਾਅਦ ਹੈਗੀ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਮੋਟੋ ਹੈਗਾ ਤੱਕੜੀ ਇਹਨਾਂ ਨੇ ਜਿਹੜਾ ਗਰੀਬ ਤੇ ਜਿਹੜਾ ਅਮੀਰ ਹੈ ਉਹਨਾਂ ਨੂੰ ਦੋਨਾਂ ਨੂੰ ਬੈਲੇਂਸ ਦੇ ਵਿੱਚ ਰੱਖਿਆ ਜਿਹੜਾ ਗਰੀਬ ਹੈ ਉਹਨਾਂ ਨਾਲ ਕਿਸੇ ਤਰਾਂ ਦਾ ਕੋਈ ਡਿਸਕ੍ਰੀਮੀਨੇਸ਼ਨ ਨਾ ਹੋਵੇ ਕਿਸੇ ਨਾਲ ਕੋਈ ਤਰਾਂ ਦਾ ਭੇਦ ਭਾਵ ਨਾ ਹੋਵੇ ਕਿਉਂਕਿ ਦੇਖੋ ਜਿਹੜੇ ਗਰੀਬ ਲੋਕ ਨੇ ਜੇ ਉਹਨਾਂ ਨਾਲ ਡਿਸਕ੍ਰੀਮੀਨੇਸ਼ਨ ਹੋਊਗਾ ਤਾਂ ਉਹ ਉੱਪਰ ਕਿਵੇਂ ਆਉਣਗੇ ਠੀਕ ਹੈ ਇਸ ਤਰ੍ਹਾਂ ਨੇ ਉਹ ਸਾਰੇ ਚੀਜ਼ਾਂ ਨੂੰ ਉਹਨਾਂ ਨੇ ਬੈਲੇਂਸ ਦੇ ਵਿੱਚ ਰੱਖਿਆ ਹੁਣ ਜਿਵੇਂ ਕਾਂਗਰਸ ਹੈ ਕਾਂਗਰਸ ਦਾ ਕੀ ਹੈ ਮੋਟੋ ਹੱਥ ਕਿ ਅਸੀਂ ਸਾਰੇ ਹੀ ਤੁਹਾਡੇ ਨਾਲ ਹਾਂ ਹੁਣ ਜਿਵੇਂ ਪੰਜਾਬ ਦਾ ਦੇਖੋ ਕਾਂਗਰਸ ਦੇ ਹੱਥ ਵਿੱਚ ਸੀਗਾ ਹਾਂ ਠੀਕ ਹੈ ਉਹਦੇ ਵਿੱਚ ਸਾਡਾ ਮਹਾਰਾਜਾ ਸਾਡੇ ਨਾਲ ਹੈ ਉੱਥੇ ਕਿੰਨੀ ਜ਼ਿਆਦਾ ਐਡਮਨੀਸਟ੍ਰੇਸ਼ਨ ਨਾਲ ਰਿਲੇਟਿਡ ਆਪਣੇ ਕੋਈ ਜਿਵੇਂ ਕੰਨਸਟਰਕਸ਼ਨ ਵਰਕ ਹੋ ਗਿਆ ਸੜਕਾਂ ਦਾ ਹੋ ਗਿਆ ਸਾਰਾ ਦਾ ਕੰਮ ਕੌਣ ਕਰ ਰਹੀ ਹੈ ਆਪਣੀ ਕਾਂਗਰਸ ਪਾਰਟੀ ਨੇ ਕੀਤਾ ਸੀ ਠੀਕ ਹੈ ਉਸ ਤੋਂ ਬਾਅਦ ਜਿਵੇਂ ਬੀ ਜੇ ਪੀ ਹੈ ਬੀ ਜੇ ਪੀ ਦਾ ਹੈਗਾ ਕਮਲ ਦਾ ਫੁੱਲ ਉਹ ਸਾਡੇ ਨਾਲ ਇਮੋਸ਼ਨ ਫੀਲਿੰਗਸ ਨੂੰ ਸਾਡੇੇ ਨਾਲ ਸਮਝਦੇ ਨੇ ਸਾਡੇ ਨਾਲ ਅਟੈਚਡ ਨੇ ਸਾਰਾ ਉਹਨਾਂ ਦਾ ਕੰਮ ਵੀ ਉਹਨਾਂ ਦੇ ਮੋਟੋ ਦੇ ਨਾਲ ਰਿਲੇਟਿਡ ਹੈ ਕਿ ਸਾਰੇ ਆਪਣੇ ਜਿਹੜੇ ਵੀ ਚਾਰ ਪੰਜ ਪਾਰਟੀਆਂ ਨੇ ਇਹ ਆਪਣੇ ਮੋਟੋ ਦੇ ਨਾਲ ਹੀ ਲੇਟ ਹੋ ਕੇ ਆਪਣਾ ਕੰਮ ਕਰਦੇ ਹਨ ਥੈਂਕ ਯੂ